ਹੈਲੋ ਹਾਂਜੀ ਨਮਸਕਾਰ ਭਾਅ ਜੀ ਹਾਂਜੀ ਭਾਅ ਜੀ ਸਾਡੇ ਨਾ ਜੀ ਅ ਅਸੀਂ ਇਲੈਕਟ੍ਰੀਸ਼ਨ ਦਾ ਕੰਮ ਕਰਵਾਉਣਾ ਸੀ ਜੀ ਆਪਦੇ ਘਰ ਅਤੇ ਉਹਦੇ ਵਿੱਚ ਜੀ ਇਹ ਦੇਖਣਾ ਜੀ ਆਪਣੇ ਨਾ ਵਾਇਰਿੰਗ ਵਗੈਰਾ ਉਸ ਹਿਸਾਬ ਨਾਲ ਸੈੱਟ ਕਰਨੀ ਹੈ ਜੀ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਕਰੰਟ ਵਗੈਰਾ ਦੇ ਕੋਈ ਦਿੱਕਤ ਨਾ ਹੋ ਜੇ ਮੰਨ ਲਓ ਕੱਲ੍ਹ ਨੂੰ ਕੋਈ ਕਰੰਟ ਨਾ ਲੱਗ ਜੇ ਹਾਂਜੀ ਹਾਂਜੀ ਭਾਅ ਜੀ ਸੇਫਟੀ ਮੈਜ਼ਰ ਆਪਣੇ ਧਿਆਨ ਕਰਨੀ ਹੈ ਜੀ ਇੱਕ ਤਾਂ ਜੀ ਇੱਕ ਤਾਂ ਫਾਇਰ ਅਲਾਰਮ ਲਵਾਉਣਾ ਜੀ ਘਰੇ ਕੀ ਘਰੇ ਘਰੇ ਅੱਗ ਵਗੈਰਾ ਦਾ ਕੋਈ ਦਿੱਕਤ ਆ ਤਾਂ ਉਹ ਮਤਲਬ ਉਹਦਾ ਫਾਇਰ ਦਾ ਜੇ ਕੋਈ ਲੱਗਦਾ ਤਾਂ ਪਤਾ ਚੱਲ ਜਾਏ ਜੀ ਘਰੇ ਬਾਕੀ ਜੇ ਕੋਈ ਛੋਟੇ ਮੋਟੇ ਹੋਰ ਜਿਵੇਂ ਜੀ ਆਪਣੇ ਵਾਇਰਿੰਗ ਪੁਆਇੰਟ ਆ ਜੇ ਧਿਆਨ ਰੱਖਣੇ ਆ ਜੀ ਕੋਈ ਉਹਨਾਂ ਦੇ ਓਪਨ ਨਾ ਰਹਿ ਜੇ ਸਾਰੇ ਚੈੱਕ ਕਰਵਾਉਣੇ ਆ ਜੀ ਦੁਬਾਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਭਾਅ ਜੀ ਉਹ ਸਾਰੇ ਘਰੇ ਲਵਾਉਣੇ ਜੀ ਆਪਣੇ ਸਾਰੇ ਦਿੱਕਤ ਨਾ ਆਵੇ ਕੋਈ ਵੀ ਇੱਥੇ ਵੀ ਮੰਨ ਲਓ ਦਿੱਕਤ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਚੱਲ ਜੇ ਜੀ ਨਾਲ ਦੀ ਨਾਲ ਹਾਂਜੀ ਭਾਅ ਜੀ ਭਾਅ ਜੀ ਉਹ ਹੁੰਦਾ ਆਪਾਂ ਨੂੰ ਕਿੰਨਾ ਕੁ ਖਰਚਾ ਪੈ ਜਾਵੇਗਾ ਜੀ

ਠੀਕ ਹੈ ਭਾਅ ਜੀ ਅਤੇ ਭਾਅ ਜੀ ਜਿਹੜੇ ਆਪਣੇ ਉਹ ਬੋਰਡਸ ਵਗੈਰਾ ਯੂਜ ਕਰਨੇ ਆ ਉਹ ਉਹ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਜੀ ਕੋਈ ਕਰੰਟ ਵਗੈਰਾ ਦੀ ਦਿੱਕਤ ਨਾ ਆਵੇ ਜੀ

ਹਾਂ ਹਾਂਜੀ ਹਾਂਜੀ ਭਾਅ ਜੀ ਉਹ ਵਰਕਿੰਗ ਹੋਈ ਹੋਈ ਹੈ ਮੇਨ ਆਪਣੇ ਜੀ ਆਪਣਾ ਉਹ ਸੁੱਚ ਵਗੈਰਾ ਕਰਵਾਉਣੇ ਆ ਜੀ ਮਤਲਬ ਕੋਈ ਦਿੱਕਤ ਕਰੰਟ ਵਗੈਰਾ ਨਾ ਆਜੇ ਜੀ ਬੱਚਿਆਂ ਨੂੰ ਕਿਉਂਕਿ ਬੱਚੇ ਛੋਟੇ ਆ ਜੀ ਅਤੇ ਉਸ ਨਾਲ ਫਿਰ ਔਨ ਵਗੈਰਾ ਕਰਨ ਤਾਂ ਕਰਕੇ ਦਿੱਕਤ ਨਾ ਹੋਵੇ ਜੀ ਉਹਨਾਂ ਨੂੰ ਠੀਕ ਹੈ ਹਾਂਜੀ ਹਾਂਜੀ ਭਾਅ ਜੀ ਕੋਈ ਗੱਲ ਨਹੀਂ ਖਰਚੇ ਦਾ ਕੋਈ ਗੱਲ ਨਹੀਂ ਭਾਅ ਜੀ ਉਹ ਤਾਂ ਤੁਸੀਂ ਦੇਖ ਕੇ ਬਾਕੀ ਚੈੱਕ ਕਰ ਲਿਆ ਜੀ ਕਿੰਨਾ ਕੁ ਆਪਣਾ ਬਣੇਗਾ ਜੀ ਠੀਕ ਹੈ ਭਾਅ ਜੀ ਅਤੇ ਆਪਣੇ ਭਾਅ ਜੀ ਕਦੋਂ ਕਦੋਂ ਤੁਸੀਂ ਆਓਗੇ ਜੀ ਚਲੋ ਠੀਕ ਹੈ ਭਾਅ ਜੀ ਤੁਸੀਂ ਆਉਣ ਤੋਂ ਪਹਿਲੇ ਇੱਕ ਵਾਰੀ ਕਾਲ ਕਰ ਲਿਆ ਜੀ ਓਕੇ ਸਰ